ਮੈਂ ਇੱਕ ਪੰਜਾਬੀ ਵਿਰਸੇ ਦੀ ਕਲਾ ਪ੍ਰਦਰਸ਼ਨੀ ਵਿੱਚ ਗਈ ਸੀ ਮੈਂ ਉੱਥੇ ਦੇਖਿਆ ਵੀ ਜੋ ਵੀ ਪਿੱਛੇ ਮਤਲਬ ਪੁਰਾਣੇ ਬਜ਼ੁਰਗ ਕੰਮ ਕਰਦੇ ਸੀ ਜਾਂ ਬੀਬੀਆਂ ਘਰੇ ਕੰਮ ਕਰਦੀਆਂ ਉਹ ਸਾਰਾ ਕੁਛ ਉੱਥੇ ਮੈਂ ਦੇਖਿਆ ਜਿਵੇਂ ਕਿ ਚਰਖਾ ਕੱਤਣਾ ਅਤੇ ਦਰੀਆਂ ਬੁਣਨੀਆਂ ਦਾ ਅਤੇ ਨਾਲੇ ਬੁਣਨੇ ਅਤੇ ਜਾ ਵੀ ਜੋ ਵੀ ਮਤਲਬ ਪਹਿਲਾਂ ਕਰਦੀਆਂ ਸੀ ਬੀਬੀਆਂ ਜਿਵੇਂ ਹੁਣ ਬੰਦੇ ਸੀਗੇ ਹੱਥਾਂ ਨਾਲ ਖੇਤੀ ਕਰਦੇ ਸੀ ਉਹ ਸੰਦ ਵੇਖੇ ਅਤੇ ਵਧੀਆ ਲੱਗਾ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਅਤੇ ਹੋਰ ਕਈ ਕੰਮ ਮਤਲਬ ਜੋ ਵੀ ਕਰਦੀਆਂ ਸੀ ਬੀਬੀਆਂ ਘਰ ਵੀ ਸਾਰਾ ਆਟਾ ਚੱਕੀ ਜਿਹੜੀਆਂ ਉਹ ਚੱਕੀਆਂ ਜਿਹੜੀਆਂ ਸੀ ਉਹਨਾਂ ਨਾਲ ਮਤਲਬ ਕਣਕ ਪੀਸਦੀਆਂ ਸੀ ਆਟਾ ਬਣਾਉਂਦੀਆਂ ਸੀ ਅਤੇ ਉਹਦੀ ਰੋਟੀ ਬਣਦੀ ਸੀ ਅਤੇ ਉਹ ਸਾਰਾ ਕੁਝ ਅਸੀਂ ਦੇਖਿਆ ਜੋ ਕਹੀਆਂ ਦਾਤੀਆਂ ਰੰਬੇ ਅਤੇ ਹਲਟ ਜੋ ਵੀ ਜ ਪਾਣੀ ਕੱਢਦੇ ਸੀ ਬਲਦਾਂ ਨਾਲ ਖੇਤੀ ਹੁੰਦੀ ਸੀਗੀ ਉਹ ਸਾਰਾ ਕੁਝ ਉੱਥੇ ਸੀ ਅਤੇ ਸਾਨੂੰ ਮਤਲਬ ਵਧੀਆ ਲੱਗਾ ਵੀ ਵੇਖ ਕੇ ਬੜਾ ਰੂਹ ਖੁਸ਼ ਹੋਈ ਵੀ ਇਹੀ ਚੀਜ਼ ਸਾਨੂੰ ਹੁਣ ਉਹਦੇ ਬੱਚਿਆਂ ਨੂੰ ਨਹੀਂ ਪਤਾ ਉਹਦੇ ਬੱਚੇ ਸਿਰਫ ਕਿਤਾਬੀ ਕੀੜਾ ਬਣ ਕੇ ਰਹਿ ਗਏ ਕਿਤਾ ਕਿਤਾਬਾਂ ਵਿੱਚ ਜੋ ਉਹਨਾਂ ਨੇ ਪੜ੍ਹਿਆ ਉਹੀ ਉਹਨਾਂ ਨੂੰ ਪਤਾ ਅਤੇ ਅਸੀਂ ਹੁਣ ਜੋ ਮਤਲਬ ਹੁਣ ਜਿਹਦੇ ਵੀ ਜਾਈਏ ਪ੍ਰਦਰਸ਼ਨੀ ਲੱਗੇ ਤਾਂ ਸਾਨੂੰ ਵੀ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਈਏ ਉਹਨਾਂ ਨੂੰ ਵਿਖਾਈਏ ਵੀ ਇਹ ਪੁਰਾਣੇ ਸੰਦ ਨੇ ਪੁਰਾਣੇ ਸੰਦਾਂ ਨਾਲ ਕਿਵੇਂ ਖੇਤੀ ਹੁੰਦੀ ਸੀ ਕਿਵੇਂ ਬੀਬੀਆਂ ਘਰ 'ਚ ਕੰਮ ਕਰਦੀਆਂ ਸੀ ਚੁੱਲ੍ਹੇ ਚੌਂਕੇ ਦਾ ਅਤੇ ਹਲ ਪੰਜਾਲੀ ਬੰਦੇ ਸਾਰੇ ਇਹ ਕਰਦੇ ਸੀ ਕੰਮ ਅਤੇ ਹੱਥਾਂ ਨਾਲ ਖੇਤੀ ਕਰਦੇ ਸੀ ਅਤੇ ਬੀਬੀਆਂ ਹੱਥਾਂ ਨਾਲ ਸਾਰਾ ਕੰਮ ਕਰਦੀਆਂ ਸੀ ਅਤੇ ਝਾੜੇ ਪ ਝਾੜੂ ਪੋਚੇ ਨਹੀਂ ਸੀ ਹੁੰਦੇ ਉਦੋਂ ਤਾਂ ਸਿਰਫ ਲੇਪਣ ਕਰਦੀਆਂ ਸੀਗੀਆਂ ਘਰਾਂ ਦੇ ਵਿੱਚ ਅਤੇ ਉਹ ਸਾਰਾ ਕੁਛ ਹੀ ਸਾਨੂੰ ਉੱਥੇ ਵੇਖਣ ਨੂੰ ਮਿਲਿਆ ਅਤੇ ਸਾਨੂੰ ਬਹੁਤ ਹੀ ਵਧੀਆ ਲੱਗਾ ਸਾਨੂੰ ਚਾਹੀਦਾ ਵੀ ਅਸੀਂ ਜਾਈਏ ਜਿੱਥੇ ਵੀ ਕਿਤੇ ਪ੍ਰਦਰਸ਼ਨੀ ਲੱਗੇ ਤੇ ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਈਏ ਉਹਨਾਂ ਨੂੰ ਵਿਖਾਈਏ ਵੇਖੋ ਸਾਡਾ ਇਹ ਪੰਜਾਬੀ ਵਿਰਸਾ ਪੁਰਾਣਾ ਸਾਨੂੰ ਵਿਖਾਉਣਾ ਚਾਹੀਦਾ ਬੱਚਿਆਂ ਨੂੰ